ਅਸੀਂ ਕੀ ਹੈ ਅਨੰਦਪੁਰ ਸਾਹਿਬ ਗਏ ਅਤੇ ਉਸ ਦੌਰਾਨ ਕੀ ਹੈ ਮੈਨੂੰ ਮਤਲਬ ਕੀ ਹੈ ਇੱਦਾਂ ਸੀਗਾ ਉੱਥੇ ਜਿਵੇਂ ਮਤਲਬ ਗੁਰੂ ਘਰ ਮੱਥਾ ਟੇਕਿਆ ਵਧੀਆ ਢੰਗ ਨਾਲ ਅਤੇ ਜਿਹੜੇ ਮਤਲਬ ਕਿ ਲੋਕ ਕਈ ਮੈਨੇ ਬੱਚੇ ਮਤਲਬ ਕਿ ਮੇਰੀ ਉਮਰ ਦੇ ਦੇਖੇ ਇਹੋ ਜਿਹੇ ਜਿਹਨਾਂ ਨੂੰ ਕਿ ਹੈ ਉਹ ਇੱਦਾਂ ਪੁੱਛ ਰਹੇ ਸੀ ਜਿਵੇਂ ਉਹ ਪਹਿਲੀ ਵਾਰੀ ਆਏ ਹੋਣ ਹਾਲਾਂਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਸਾਡਾ ਕਲਚਰ ਹੈ ਕਿ ਅਸੀਂ ਗੁਰੂ ਘਰ ਮਤਲਬ ਪਰੋਪਰ ਜਾਂਦੇ ਹਾਂ ਸਾਨੂੰ ਪਤਾ ਹੈ ਵੀ ਕਿੱਥੇ ਬਾਣੀ ਅਤੇ ਕੀ ਕਰੀਦਾ ਹੁੰਦਾ ਹੈ ਨਾ ਅਤੇ ਉਨ੍ਹਾਂ ਨੂੰ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਵੀ ਹਾਂ ਇਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਤਾਂ ਕੀ ਹੈ ਜਿਹੜੇ ਮੇਰੇ ਮਤਲਬ ਕਿ ਸਾਥੀ ਸੀਗੇ ਤਾਂ ਮਤਲਬ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਮਤਲਬ ਇਸ ਆਪਣਾ ਕਲਚਰ ਹੈ ਆਪਣੇ ਮਤਲਬ ਗੁਰੂਆਂ ਦੀ ਬਾਣੀ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਆਪਾਂ ਨੂੰ ਇਸ ਚੀਜ਼ ਬਾਰੇ ਮਤਲਬ ਕਿ ਪੜ੍ਹਨਾ ਚਾਹੀਦਾ ਹੈ ਪਰੋਪਰ ਆਪਾਂ ਨੂੰ ਹਰੇਕ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਚੀਜ਼ ਬਾਰੇ ਮੈਂ ਉਹਨਾਂ ਨੂੰ ਦੱਸਿਆ